ਸਾਡੇ ਖੇਤਰ ਦਾ ਮੌਸਮ ਬਦਲਦਾ ਹੀ ਰਹਿੰਦਾ ਹੈ ਇਹ ਗਲੋਬਲ ਵਾਰਮਿੰਗ ਕਰਕੇ ਵਾਤਾਵਰਨ ਬਦਲ ਰਿਹਾ ਹੈ ਜਦੋਂ ਫਸਲਾਂ ਪੱਕਦੀਆਂ ਹਨ ਤਦ ਜਾਂ ਗੜੇਮਾਰੀ ਜਾਂ ਹੜ ਆ ਜਾਂਦੇ ਹਨ ਜਿਸ ਨਾਲ ਸਾਡੀ ਸਾਰੀ ਫਸਲ ਖਰਾਬ ਹੋ ਜਾਂਦੀ ਹੈ ਪਹਿਲਾਂ ਬਾਰਿਸ਼ ਸੋਣ ਦੇ ਮਹੀਨੇ ਵਿੱਚ ਆਉਂਦੀ ਸੀ ਪਰ ਹੁਣ ਬਾਰਿਸ਼ ਭਾਦੋਂ ਦੇ ਮਹੀਨੇ ਵਿੱਚ ਆਉਂਦੀ ਹੈ ਜਿਸ ਨਾਲ ਫਸਲਾਂ 'ਤੇ ਵੀ ਭਾਰੀ ਨੁਕਸਾਨ ਹੁੰਦਾ ਹੈ ਅਤੇ ਕਈ ਵਾਰੀ ਸੌਕਾ ਵੀ ਪੈ ਜਾਂਦਾ ਜਿਸ ਨਾਲ ਫਸਲ ਫਿਰ ਪ੍ਰਭਾਵਿਤ ਹੋ ਜਾਂਦੀ ਹੈ ਮੌਸਮ ਦੇ ਬਦਲ ਨਾਲ ਫਸਲਾਂ ਦਾ ਝਾੜ ਵੀ ਘੱਟ ਜਾਂਦਾ ਹੈ ਜਿਸ ਨਾਲ ਸਾਡੀ ਕਮਾਈ ਘੱਟਦੀ ਹੈ ਅਤੇ ਸਾਡੇ ਜੀਵਨ 'ਤੇ ਵੀ ਅਸਰ ਪੈਂਦਾ ਹੈ ਗਰਮੀ ਵਿੱਚ ਹੁਣ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਹੈ ਜਿਸ ਨਾਲ ਸਾਨੂੰ ਘਰਾਂ ਵਿੱਚ ਏ ਸੀ ਲਗਾਉਣੇ ਪੈਂਦੇ ਹਨ ਜਿਸ ਨਾਲ ਸਾਡੇ ਖਰਚੇ ਵੀ ਵੱਧਦੇ ਹਨ ਸਰਦੀਆਂ ਵਿੱਚ ਠੰਡ ਵੀ ਬਹੁਤ ਪੈਣ ਲੱਗ ਗਈ ਹੈ ਪਹਿਲਾਂ ਠੰਡ ਲੋਹੜੀ ਦੇ ਤਿਓਹਾਰ ਤੋਂ ਬਾਅਦ ਘੱਟ ਜਾਂਦੀ ਸੀ ਪਰ ਹੁਣ ਲੋਹੜੀ ਤੋਂ ਬਾਅਦ ਠੰਡ ਜ਼ਿਆਦਾ ਪੈਣ ਲੱਗ ਜਾਂਦੀ ਹੈ ਫਸਲ ਦੇ ਉਪਾਅ ਲਈ ਹੁਣ ਫਸਲਾਂ ਪਹਿਲਾਂ ਹੀ ਵੱਢ ਦਿੱਤੀਆਂ ਜਾਂਦੀਆਂ ਹਨ ਮੌਸਮ ਵੇਖ ਕੇ ਮੌਸਮ ਅਨੁਸਾਰ ਫਸਲਾਂ ਦੀ ਕਟਾਈ ਕੀਤੀ ਜਾਂਦੀ ਹੈ ਜੇਕਰ ਮੌਸਮ ਵਿੱਚ ਤਬਦੀਲੀ ਹੋਵੇ ਤਾਂ ਫਸਲ ਪਹਿਲਾਂ ਹੀ ਕੰਬਾਈਨ ਲਾ ਕੇ ਵੱਢ ਦਿੱਤੀ ਜਾਂਦੀ ਹੈ ਅਤੇ ਘਰਾਂ ਵਿੱਚ ਸੰਭਾਲ ਦਿੱਤੀ ਜਾਂਦੀ ਹੈ ਜਿਸ ਨਾਲ ਸੰਭਾਲ ਦਿੱਤੀ ਜਾਂਦੀ ਕਈ ਵਾਰੀ ਸਾਡੀ ਫਸਲਾਂ 'ਤੇ ਕੀੜੇ ਮਾਰੀ ਵੀ ਹੋ ਜਾਂਦੀ ਹੈ ਜਿਸ ਨਾਲ ਫਸਲ ਖਰਾਬ ਹੁੰਦੀ ਹੈ ਇਹ ਸਭ ਕੁਝ ਹੁਣ ਬਦਲਦੇ ਮੌਸਮ ਕਾਰਨ ਹੁੰਦਾ ਪਿਆ ਹੈ ਪਹਿਲਾਂ ਮੌਸਮ ਵਧੀਆ ਰਹਿੰਦੇ ਸੀ ਜਿਸ ਨਾਲ ਕਿਸਾਨਾਂ ਨੂੰ ਫਸਲਾਂ ਤੋਂ ਵਧੇਰੇ ਆਮਦਨ ਪ੍ਰਾਪਤ ਹੁੰਦੀ ਸੀ ਅਤੇ ਉਹਨਾਂ ਦਾ ਵਧੀਆ ਰੁਜ਼ਗਾਰ ਚੱਲੀ ਜਾਂਦਾ ਸੀ ਪਰ ਹੁਣ ਕੁਝ ਫਸਲਾਂ ਮੌਸਮ ਕਰਕੇ ਅਤੇ ਫਸਲਾਂ ਦੇ ਰੇਟ ਕਾਰਨ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ